ਸਤਿ ਸ਼੍ਰੀ ਅਕਾਲ ਜੀ ਜਦੋਂ ਕਰੋਨਾ ਆਇਆ ਸੀ ਤਾਂ ਸਰਕਾਰ ਨੇ ਲੋਕਡਾਊਨ ਲਗਾ ਦਿੱਤਾ ਸੀ ਅਤੇ ਉਸ ਦੌਰਾਨ ਸਭ ਕੁਛ ਬੰਦ ਹੋ ਗਿਆ ਸੀ ਲੋਕਾਂ ਦਾ ਘਰੋਂ ਨਿਕਲਣਾ ਵੀ ਬੰਦ ਹੋ ਗਿਆ ਸੀ ਅਤੇ ਸਭ ਰੈਸਟੋਰੈਂਟ ਸਭ ਦੁਕਾਨਾਂ ਸਭ ਕੁਛ ਬੰਦ ਸੀ ਬੱਚਿਆਂ ਨੂੰ ਸਕੂਲ ਤੋਂ ਵੀ ਛੁੱਟੀਆਂ ਪੈ ਗਈਆਂ ਸੀ ਅਤੇ ਬੱਚਿਆਂ ਦਾ ਵੱਡਿਆਂ ਦਾ ਸਭ ਦਾ ਹੀ ਚਟਪਟਾ ਬਾਹਰ ਦਾ ਖਾਣਾ ਫਾਸਟ ਫੂਡ ਸਭ ਬੰਦ ਸੀ ਮੇਰੇ ਬੱਚੇ ਹਰ ਵੇਲੇ ਮੈਨੂੰ ਘਰ ਵਿੱਚ ਕੁਛ ਵਧੀਆ ਬਣਾ ਕੇ ਖਵਾਉਣ ਲਈ ਕਹਿੰਦੇ ਸੀ ਅਤੇ ਫਿਰ ਮੈਂ ਇੱਕ ਦਿਨ ਯੂਟੀਊਬ ਤੋਂ ਦੇਖ ਕੇ ਕੁਛ ਰੈਸਪੀ ਬਣਾਉਣ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਤਾਂ ਅਸੀਂ ਘਰ ਵਿੱਚ ਕੇਕ ਬਣਾਇਆ ਜੋ ਕਿ ਬਹੁਤ ਸਵਾਦ ਬਣਿਆ ਅਤੇ ਸਭ ਨੂੰ ਬਹੁਤ ਪਸੰਦ ਆਇਆ ਅਤੇ ਮੇਰੇ ਬੱਚਿਆਂ ਨੇ ਵੀ ਉਹ ਬਹੁਤ ਖੁਸ਼ ਹੋ ਕੇ ਖਾਧਾ ਅਤੇ ਫਿਰ ਮੇਰਾ ਵੀ ਥੋੜ੍ਹਾ ਹੌਂਸਲਾ ਵਧਿਆ ਕਿ ਚਲੋ ਘਰ ਵਿੱਚ ਕਿਉਂ ਨਾ ਹੋਰ ਚੀਜ਼ਾਂ ਬਣਾ ਕੇ ਬੱਚਿਆਂ ਨੂੰ ਖਵਾਈਆਂ ਜਾਣ ਅਤੇ ਮੇਰੇ ਬੱਚੇ ਘਰ ਵਿੱਚ ਗੋਲ ਗੱਪੇ ਬਣਾ ਕੇ ਦੇਣ ਦੀ ਡਿਮਾਂਡ ਕਰਨ ਲੱਗੇ ਅਤੇ ਅਸੀਂ ਇੱਕ ਦਿਨ ਘਰ ਵਿੱਚ ਗੋਲ ਗੱਪੇ ਬਣਾਏ ਅਤੇ ਪਹਿਲੀ ਜਦੋਂ ਪਹਿਲੀ ਵਾਰੀ ਬਣਾਏ ਤਾਂ ਉਹ ਬਿਲਕੁਲ ਸਵਾਦ ਨਹੀਂ ਬਣੇ ਉਹ ਸਾਰੇ ਟੁੱਟ ਗਏ ਅਤੇ ਖਾਣ ਵਿਚ ਵੀ ਬਿਲਕੁਲ ਸਵਾਦ ਨਹੀਂ ਸੀ ਅਤੇ ਨਾ ਹੀ ਸਾਡੇ ਕੋਲੋਂ ਕਾਂਜੀ ਬਾਹਰ ਵਰਗੀ ਬਣੀ ਸੀ ਅਤੇ ਫਿਰ ਅਸੀਂ ਦੁਬਾਰਾ ਉਹਨੂੰ ਬ ਉਹਨਾਂ ਨੂੰ ਬਣਾਇਆ ਅਤੇ ਜਦੋਂ ਦੁਬਾਰਾ ਬਣਾਇਆ ਅਤੇ ਜੋ ਗਲਤੀਆਂ ਪਹਿਲਾਂ ਹੋਈਆਂ ਸੀ ਉਹਨਾਂ ਨੂੰ ਦੁਬਾਰਾ ਫਿਰ ਨਹੀਂ ਦੁਹਰਾਇਆ ਅਤੇ ਉਹ ਫਿਰ ਬਹੁਤ ਹੀ ਸਵਾਦ ਬਣੇ ਅਤੇ ਖਾਣ ਵਿੱਚ ਵੀ ਬਹੁਤ ਵਧੀਆ ਬਣੇ ਅਤੇ ਅਸੀਂ ਘਰ ਵਿੱਚ ਹੋਰ ਵੀ ਬਹੁਤ ਸਾਰੀਆਂ ਚੀ ਚੀਜ਼ਾਂ ਬਣਾਈਆਂ ਜਿਵੇਂ ਸਮੋਸੇ ਗੁਲਾਬ ਜਾਮਨ ਬਰਫੀ ਚਾਟ ਬਹੁਤ ਕੁਛ ਅਸੀਂ ਘਰ ਵਿੱਚ ਜਿਹੜੀਆਂ ਇਹ ਡਿਸ਼ਿਜ਼ ਹੈ ਬਣਾਈਆਂ ਅਤੇ ਮੇਰੇ ਬੱਚੇ ਵੀ ਬੜੇ ਖੁਸ਼ ਹੋਣ ਲੱਗ ਪਏ ਕੁਕਿੰਗ ਕਰਕੇ ਅਤੇ ਜਦ ਅਸੀਂ ਇਹ ਡਿਸ਼ਿਜ਼ ਬਣਾਈਆਂ ਅਤੇ ਬਹੁਤ ਹੀ ਸਵਾਦ ਬਣੀਆਂ ਘਰ ਵਿਚ ਸਭ ਨੂੰ ਬਹੁਤ ਪਸੰਦ ਆਈਆਂ ਅਤੇ ਲੋਕਾਂ ਲੋਕਾਂ ਨੇ ਤਾਂ ਲੋਕਡਾਊਨ ਦੇ ਦੌਰਾਨ ਘਰ ਵਿੱਚ ਖਾਣ ਪੀਣ ਦੀਆਂ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਅਤੇ ਲੋਕਡਾਊਨ ਦੇ ਦੌਰਾਨ ਘਰ ਵਿੱਚ ਸਭ ਚੀਜ਼ਾਂ ਬਹੁਤ ਹੀ ਹੈਲਥੀ ਬਣੀਆਂ ਅਤੇ ਇਸ ਦੇ ਨਾਲ ਸਾਨੂੰ ਇਹ ਵੀ ਸਮਝ ਆਈ ਕਿ ਘਰ ਵਿੱਚ ਬਣਾਈਆਂ ਚੀਜ਼ਾਂ ਬਾਹਰ ਦੀਆਂ ਬਣਾਈਆਂ ਚੀਜ਼ਾਂ ਨਾਲੋਂ ਸਾਫ ਸੁਥਰੀਆਂ ਹੁੰਦੀਆਂ ਨੇ ਧੰਨਵਾਦ